ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਇਸ ਨੂੰ ਬੋਲਣ ਲਈ ਅਸੀਂ ਕਿਸੇ ਤੋਂ ਨਹੀਂ ਸਿੱਖਦੇ ਅਸੀਂ ਆਪਣੇ ਆਸ ਪਾਸ ਦੇਖ ਕੇ ਸਿੱਖ ਜਾਂਦੇ ਹਾਂ ਇਹ ਹੋਰ ਭਾਸ਼ਾਵਾਂ ਨਾਲੋਂ ਵੱਖਰੀ ਇਸ ਤਰ੍ਹਾਂ ਹੈ ਇਸ ਵਿੱਚ ਬਹੁਤ ਸਾਰੀਆਂ ਲਗਾ ਮਾਤਰਾਵਾਂ ਆਉਦੀਆਂ ਹਨ